ਮੈਂ ਸੁਨੀਲ ਕੁਮਾਰ ਮਿਰਜ਼ਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਸ਼ੂ ਪਾਲਣ ਵਿੱਚ ਕਿਸਾਨਾਂ ਨੂੰ ਕਿਹੜੀਆਂ ਕੁਝ ਆਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਪਸ਼ੂ ਨੂੰ ਪਾਲਣ ਵਾਸਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਨੰਬਰ ਇੱਕ ਖੇਤਾਂ ਵਿੱਚ ਪੱਠੇ ਉਗਾਉਣੇ

ਜੇ ਜਾਵਾਂਗੇ ਤਾਂ ਉਹਨਾਂ ਦੀ ਸਮੇਂ ਸਿਰ ਦੇਖਭਾਲ ਕਰਨੀ ਕਰਨ ਲਈ ਸਾਨੂੰ ਟਾਈਮ ਟੂ ਟਾਈਮ ਘਰ ਵਾਪਸ ਆਉਣਾ ਪੈਣਾ ਮੈਂ ਜਦੋਂ ਜਾਂਦਾ ਹਾਂ ਤਾਂ ਮੈਂ ਆਪਣੇ ਭਰਾ ਨੂੰ ਕਹਿ ਕੇ ਜਾਂਦਾ ਹਾਂ ਕਿ ਮੈਨੂੰ ਘਰ ਕੋਈ ਕੰਮ ਪੈ ਗਿਆ ਮੈਂ ਘਰ ਜਾ ਰਿਹਾ ਹਾਂ ਅਤੇ ਮੇਰੇ ਪਸ਼ੂਆਂ ਦੀ ਦੇਖਭਾਲ ਕਰੀ ਇਹਨਾਂ ਨੂੰ ਪੱਠੇ ਪਾਈ ਹੋਰ ਚਾਰਾ ਪਾਣੀ ਫੀਡ ਵਗੈਰਾ ਸਮੇਂ ਸਮੇਂ ਦੇ ਵਿੱਚ ਇਹਨਾਂ ਨੂੰ ਧਿਆਨ ਰੱਖੀਏ ਇਸ ਤਰ੍ਹਾਂ ਜੇ ਕੋਈ ਪਸ਼ੂ ਬਿਮਾਰ ਵੀ ਹੋ ਜਾਂਦਾ ਹੈ ਤਾਂ ਡਾਕਟਰ ਨੂੰ ਬੁਲਾਉਣਾ ਪੈਂਦਾ ਹੈ ਮੈਂ ਉਸ ਡਾਕਟਰ ਦਾ ਨੰਬਰ ਆਪਣੇ ਫੋਨ ਵਿੱਚ ਲਿਖਿਆ ਹੋਇਆ ਹੈ ਜੇ ਮੇਰਾ ਪਸ਼ੂ ਕੋਈ ਬਿਮਾਰ ਪੈ ਜਾਂਦਾ ਹੈ ਅਤੇ ਮੈਂ